ਜੋ ਹੈਂਡ ਪੰਪ ਹੈ ਉਹ ਪੇਂਡੂ ਖੇਤਰ ਵਿੱਚ ਵਧੇਰੇ ਤੌਰ 'ਤੇ ਵੇਖਿਆ ਜਾਂਦਾ ਹੈ ਮੈਂ ਖੁਦ ਪੇਂਡੂ ਖੇਤਰ ਦਾ ਹੋਣ ਕਰਕੇ ਹੈਂਡ ਪੰਪ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਾਫ਼ੀ ਵਾਰ ਇਸਤੇਮਾਲ ਕਰਦਾ ਹਾਂ ਜੋ ਹੈਂਡ ਪੰਪ ਹੈ ਜੋ ਉਹਨੂੰ ਹੱਥੀ ਲੱਗੀ ਹੁੰਦੀ ਹੈ ਜਦੋਂ ਉਹਨੂੰ ਆਪਾਂ ਗੇੜਦੇ ਹਾਂ ਜੋ ਥੱਲੇ ਪੈਪ ਵਿੱਚ ਪੁਲੀ ਲੱਗੀ ਹੁੰਦੀ ਹੈ ਤਾਂ ਉਹ ਹਵਾ ਨਾਲ ਵੈਕਿਊਮ ਨਾਲ ਉੱਤੇ ਚੱਕ ਹੁੰਦੀ ਹੈ ਅਤੇ ਜਦੋਂ ਆਪਾਂ ਉਹ ਹੱਥੀ ਨੂੰ ਢਿੱਲੀ ਛੱਡ ਦਿੰਦੇ ਹਾਂ ਤਾਂ ਉਹ ਥੱਲੇ ਬਹਿ ਜਾਂਦੀ ਹੈ ਜਿਹਦੇ ਨਾਲ ਪਾਣੀ ਉੱਤੇ ਆਉਂਦਾ ਹੈ ਪੇਂਡੂ ਖੇਤਰਾਂ ਵਿੱਚ ਹੈਂਡ ਪੰਪ ਆਮ ਤੌਰ 'ਤੇ ਵੇਖਿਆ ਜਾਂਦਾ ਹੈ ਅਤੇ ਪੁਰਾਣੇ ਸਮੇਂ ਵਿੱਚ ਹੈਂਡ ਪੰਪ ਘੱਟ ਹੋਣ ਕਰਕੇ ਜੋ ਪਿੰਡਾਂ ਦੇ ਲੋਕ ਹੈਂਡ ਪੰਪ 'ਤੇ ਲੰਬੀਆਂ ਕਤਾਰਾਂ ਬਣਾ ਕੇ ਜੋ ਪਾਣੀ ਹੈ ਉਹ ਭਰਦੇ ਸਨ ਪਰ ਅਜੋ ਪਰ ਅਜੋਕੇ ਸਮੇਂ ਵਿੱਚ ਹਰ ਘਰ ਵੱਲੋਂ ਆਪਣਾ ਇੱਕ ਨਿੱਜੀ ਹੈਂਡ ਪੰਪ ਲਗਾਇਆ ਗਿਆ ਹੈ